ਬੰਦਾ ਜੋ ਵੀ ਹੈ ਲੈਂਦਾ ਵਿਸ਼ਵਾਸ ਨਾਲ ਲੈਂਦਾ ਹੈ ਲੇਕਿਨ ਮੈਂ ਇੱਕ ਗੱਲ ਦੱਸਾਂ ਮੈਂ ਕੁਰਾਲੀ ਗਿਆ ਸੀ ਉੱਥੋਂ ਆਪਣੀ ਪੰਜਾਬੀ ਜੁੱਤੀ ਲੈ ਕੇ ਆਇਆ ਅੱਜ ਤੱਕ ਤਿੰਨ ਮਹੀਨੇ ਹੋ ਗਏ ਉਹ ਜੁੱਤੀ ਬਹੁਤ ਵਧੀਆ ਚੱਲ ਰਹੀ ਹੈ ਅਤੇ ਬਹੁਤ ਹੀ ਵਧੀਆ ਬੰਦੇ ਨੇ ਕੰਮ ਕੀਤਾ